ਲਿਖਤ ਮੇਰੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਹੈ ਮੈਂ ਕਾਫੀ ਕੁਛ ਲਿਖਦਾ ਹਾਂ ਗਾਣੇ ਤੋਂ ਲੈ ਕੇ ਫਿਲਮਾਂ ਦੀ ਸਕ੍ਰਿਪਟਾਂ ਤੋਂ ਲੈ ਕੇ ਪੋਏਮਸ ਤੱਕ ਜਿਹਨੂੰ ਅਸੀਂ ਕਵਿਤਾਵਾਂ ਵੀ ਕਹਿੰਦੇ ਹਾਂ ਕਵਿਤਾਵਾਂ ਮੈਂ ਕਾਫੀ ਲਿਖੀਆਂ ਹਨ ਮੈਂ ਅੰਗਰੇਜ਼ੀ ਵਿੱਚ ਵੀ ਕਾਫੀ ਕਵਿਤਾਵਾਂ ਲਿਖੀਆਂ ਹਨ ਅਤੇ ਹਿੰਦੀ 'ਚ ਵੀ ਕਾਫੀ ਕਵਿਤਾਵਾਂ ਲਿਖੀਆਂ ਹਨ ਮੇਰੀ ਅੰਗਰੇਜ਼ੀ ਦੀਆਂ ਕ ਕਵਿਤਾਵਾਂ ਮੈਨੂੰ ਬਹੁਤ ਪਸੰਦ ਆਉਂਦੀਆਂ ਹਨ ਮੈਨੂੰ ਅੰਗਰੇਜ਼ੀ ਵਿੱਚ ਲਿਖਣਾ ਪਸੰਦ ਹੈ ਅਤੇ ਮੈਂ ਆਪਣੇ ਲਿਖਤ ਲਈ ਵਿਚਾਰਾਂ ਤੋਂ ਉਹਦਾ ਕਾਫੀ ਇਸਤੇਮਾਲ ਕਰਦਾ ਹਾਂ ਮੈਂ ਆਪਣੇ ਭੂਤਕਾਲ ਵਿੱਚ ਕੀਤੇ ਹੋਏ ਆਪਣੇ ਹਾਦਸੇ ਯਾਦ ਕਰਕੇ ਲਿਖਦਾ ਹਾਂ ਜਿਹੜੇ ਮੈਨੂੰ ਮੇਰੀ ਲਿਖਤ ਵਿੱਚ ਬਹੁਤ ਮਦਦ ਕਰਦੇ ਹਨ ਮੇਰੀ ਪੁਰਾਣੀਆਂ ਮੈਮਰੀ ਜਿਹਨੂੰ ਕਹਿੰਦੇ ਹਨ ਉਹਨਾਂ ਤੋਂ ਕਹਾਣੀਆਂ ਕੱਢ ਕੇ ਨਵੇਂ ਅੱਖਰ ਪਾ ਕੇ ਲਿਖਣਾ ਆਪਣੇ ਥਰੂ ਦੱਸਣ ਜਿਹੜਾ ਇੱਕ ਬੰਦੇ ਦਾ ਪੁਆਇੰਟ ਆਫ ਵਿਊ ਕਹਿੰਦਾ ਹੈ ਉਸ ਪੀ ਓ ਵੀ ਨੂੰ ਦੱਸਦੇ ਹੋਏ ਕਹਾਣੀਆਂ ਨਵੀਆਂ ਨਵੀਆਂ ਲੱਗਦੀਆਂ ਹਨ ਮੈਂ ਲਿਖਣ ਵਿੱਚ ਆਪਣੇ ਵਿਚਾਰਾਂ ਦਾ ਇਸਤੇਮਾਲ ਕਰਦੇ ਕਰਦੇ ਮੈਂ ਕਾਫੀ ਸਾਰੀਆਂ ਫਿਲਮਾਂ ਵੀ ਦੇਖਦਾ ਹਾਂ ਮੈਂ ਬੋਲੀਵੁੱਡ ਤੋਂ ਲੈ ਕੇ ਹੋਲੀਵੁੱਡ ਫਿਲਮ ਜ਼ਿਆਦਾ ਦੇਖਦਾ ਹਾਂ ਹੋਲੀਵੁੱਡ ਫਿਲਮਾਂ ਮੈਨੂੰ ਬਹੁਤ ਮਦਦ ਕਰਦੀਆਂ ਹਨ ਮੇਰੀ ਕ ਲਿਖਤੀ ਨੂੰ ਇੰਪਰੂਵ ਕਰਨ ਲਈ ਮੈਂ ਆਪਣਾ ਕਹਾਣੀਆਂ ਲਿਖਦੇ ਲਿਖਦੇ ਓ ਇਹ ਫਿਲਮਾਂ ਤੋਂ ਇੰਸਪਾਇਰ ਹੋ ਕੇ ਲਿਖਦਾ ਹਾਂ ਮੈਨੂੰ ਬਹੁਤ ਪ੍ਰੇਰਨਾ ਮਿਲਦੀ ਹੈ ਜਦੋਂ ਮੈਂ ਇੱਕ ਨਵੀਂ ਚੀਜ਼ ਲਿਖਦਾ ਹਾਂ ਨਵਾਂ ਨਵੀਂ ਨਵਾਂ ਇੱਕ ਪਲੋਟ ਕ੍ਰੀਏਟ ਕਰਦਾ ਹਾਂ ਅਤੇ ਨਵੀਂ ਇੱਕ ਸਟੋਰੀ ਬਣਾਉਂਦਾ ਹਾਂ ਇਹਦੇ ਨਾਲ ਦੇ ਨਾਲ ਮੈਨੂੰ ਲਿਖਣ ਵਿੱਚ ਕਾਫੀ ਜ਼ਿਆਦਾ ਮੇਰੇ ਦੋਸਤ ਯਾਰ ਮਦਦ ਕਰਦੇ ਹਨ ਮੇਰਾ ਮੇਰਾ ਵਾਤਾਵਰਨ ਬਹੁਤ ਮਦਦ ਕਰਦਾ ਹੈ ਕਿਉਂਕਿ ਮੈਂ ਆਪਣਾ ਵਾਤਾਵਰਨ ਇਸ ਕਹਾਣੀਆਂ ਕਿਤਾਬਾਂ ਕੋਪੀਆਂ ਗਾਣਿਆਂ ਦੇ ਵਿੱਚ ਨਾਲ ਭਰਿਆ ਹੋਇਆ ਹੈ ਮੈਂ ਬਥੇਰੇ ਗਾਣੇ ਸੁਣਦਾ ਹਾਂ ਬਥੇਰੇ ਕੋਪੀਆਂ ਪੜ੍ਹਦਾ ਹਾਂ ਮੈਂ ਨੋਵਲਸ ਵੀ ਪੜ੍ਹਦਾ ਹਾਂ ਅਤੇ ਇਹ ਮੈਨੂੰ ਨਵੀਆਂ ਨਵੀਆਂ ਪਰਸਪੈਕਟਿਵ ਗੇਮ ਕਰਨ ਵਿੱਚ ਹੈਲਪ ਕਰਦੀ ਹੈ ਫਿਲਮਾਂ ਦੇ ਨਾਲ ਨਾਲ ਮੈਂ ਇੱਕ ਆਪਣੀਆਂ ਕਹਾਣੀਆਂ ਬਣਾਉਣੀਆਂ ਸਿੱਖਦਾ ਹਾਂ ਅਤੇ ਮੈਨੂੰ ਲਿਖਣ ਵਿੱਚ ਕਾਫੀ ਪ੍ਰੇਰਨਾ ਮਿਲਦੀ ਹੈ ਕੁਦਰਤ ਵੱਲੋਂ ਸਮਾਜ ਵੱਲੋਂ ਸੱਭਿਆਚਾਰ ਵੱਲੋਂ ਅਤੇ ਇਹ ਇਹਦੀਆਂ ਭਾਵਨਾਨਾ ਭਾਵਨਾਵਾਂ ਨੂੰ ਜਦੋਂ ਮੈਂ ਬੋਲਦਾ ਹਾਂ ਲਿਖਦਾ ਹਾਂ ਅਤੇ ਇਹਦੀਆਂ ਫਿਲਮਾਂ ਬਣਾਉਂਦਾ ਹਾਂ ਮੈਨੂੰ ਮਜ਼ਾ ਆਉਂਦਾ ਹੈ ਮੈਨੂੰ ਸੱਭਿਆਚਾਰ ਹੋਲੀਵੁੱਡ ਵੱਲੋਂ ਦਾ ਦੇਖ ਕੇ ਪਰਖ ਕੇ ਉਹਨੂੰ ਲਿਖਣਾ ਇੱਕ ਨਵੀਂ ਚੀਜ਼ ਕ੍ਰੀਏਟ ਕਰਦਾ ਹੈ ਅਤੇ ਮੇਰੇ ਵੱਲੋਂ ਵੀ ਮੇਰੀ ਕ੍ਰੀਏਟਿਵਿਟੀ ਜਦੋਂ ਮੈਂ ਲਿਖ ਕੇ ਕੁਛ ਵਧੀਆ ਲਿਖ ਕੇ ਉਹਨੂੰ ਪੜ੍ਹਦਾ ਹਾਂ ਜਾਂ ਸੁਣਾਉਂਦਾ ਹਾਂ ਦੂਜਿਆਂ ਨੂੰ ਸੁਣਾਉਂਦਾ ਹਾਂ ਮੈਨੂੰ ਵਧੀਆ ਲੱਗਦਾ ਹੈ ਅਤੇ ਮੈਂ ਇੱਦਾਂ ਹੀ ਫੀਡਬੈਕ ਲੈ ਲੈ ਕੇ ਉਹਨਾਂ ਤੋਂ ਇਮਪਰੂਵ ਦਿਖਾਉਂਦਾ ਹਾਂ ਧੰਨਵਾਦ